ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਓਕੇ ਓਕੇ ਹਾਂਜੀ ਬਿਲਕੁਲ ਦੇ ਸਕਦੇ ਹਾਂ ਹੁਣੀ ਸਾਡੇ ਨਾ ਟਵੈਂਟੀ ਤੋਂ ਟਵੈਂਟੀ ਸੈਵਨ ਜਨਵਰੀ ਦੇ ਵਿੱਚ ਵੱਖ ਵੱਖ ਟੂਰਿਸਟ ਸਪੋਟਸ 'ਤੇ ਸਾਡੇ ਨੇ ਜਿਹੜੇ ਜਾ ਰਹੇ ਨੇ ਅਤੇ ਉਹਦੇ ਵਿੱਚ ਹੈਗਾ ਤੁਸੀਂ ਜਾ ਸਕਦੇ ਹੈਗੇ ਹੋ ਆਪਣਾ ਹਿਮਾਚਲ ਦੇ ਵਿੱਚ ਸ਼ਿਮਲੇ ਜਾ ਸਕਦੇ ਹੋ ਜੰਮੂ ਕਸ਼ਮੀਰ ਜਾ ਸਕਦੇ ਹੋ ਨੈਨੀਤਾਲ ਉਹਦੇ ਵਿੱਚ ਅਸੀਂ ਭੇਜ ਰਹੇ ਹਾਂ ਅਤੇ ਇਸ ਤੋਂ ਇਲਾਵਾ ਅਸੀਂ ਰ ਰਾਜਸਥਾਨ ਦੇ ਵਿੱਚ ਜੈਪੁਰ ਭੇਜ ਰਹੇ ਹੈਗੇ ਹਾਂ ਅਤੇ ਤੁਸੀਂ ਜਿਹੜੇ ਵੀ ਸਪੋਟ 'ਤੇ ਜਾਣਾ ਚਾਹੋਗੇ ਤੁਹਾਨੂੰ ਉਹਦੇ ਅਕੋਰਡਿੰਗ ਅਸੀਂ ਦੱਸ ਦੇਵਾਂਗੇ ਪੂਰਾ ਪ੍ਰੋਸੀਜਰ ਕੀ ਹੋਊਗਾ ਪਰ ਪਰਸਨ ਦਸ ਤੋਂ ਵੀਹ ਹਜ਼ਾਰ ਦੇ ਵਿੱਚ ਆਊਗਾ ਵੈਸੇ ਇਹ ਟੋਟਲੀ ਡਿਪੈਂਡ ਕਰੇਗਾ ਵੀ ਤੁਸੀਂ ਜਾਣਾ ਕਿਹੜੀ ਸਪੋਟ 'ਤੇ ਹੈ ਜੇ ਤੁਸੀਂ ਥੋੜ੍ਹਾ ਦੂਰ ਜਾ ਰਹੇ ਹੋ ਜਿਵੇਂ ਗੋਆ ਵੀ ਜਾ ਰਹੇ ਹੈਗੇ ਹਾਂ ਤਾਂ ਉਹਦੇ ਥੋੜ੍ਹੇ ਜਿਹੇ ਚਾਰਜਿਜ ਵੱਧ ਜਾਣਗੇ ਜੇ ਤੁਸੀਂ ਨੇੜੇ ਸ਼ਿਮਲੇ ਤੱਕ ਹੀ ਜਾਣਾ ਹੈਗਾ ਤਾਂ ਉਹਦੇ ਵਿੱਚ ਦਸ ਕੁ ਹਜ਼ਾਰ ਤੱਕ ਮਤਲਬ ਹੋ ਜਾਊਗਾ ਕਿਉਂਕਿ ਅਸੀਂ ਨਾਲ ਤੁਹਾਨੂੰ ਹੋਟਲ ਵੀ ਪ੍ਰੋਵਾਈਡ ਕਰਵਾਵਾਂਗੇ ਉਹਦੀ ਤੁਹਾਨੂੰ ਉੱਥੇ ਜਾ ਕੇ ਟੈਨਸ਼ਨ ਨਹੀਂ ਰਹੇਗੀ ਵੀ ਅਸੀਂ ਹੋਟਲ ਕਿਹੜਾ ਲਈਏ ਹੋਟਲ ਅਸੀਂ ਤੁਹਾਨੂੰ ਇੱਥੋਂ ਹੀ ਬੁੱਕ ਕਰਵਾ ਕੇ ਭੇਜਾਂਗੇ ਅਤੇ ਨਾਲ ਤੁਹਾਨੂੰ ਸਾਰੀ ਮੈਡੀਕਲ ਫੈਸਲਿਟੀ ਦਿੱਤੀ ਜਾਊਗੀ ਹਾਂਜੀ ਹਾਂਜੀ ਓਕੇ

ਹਾਂਜੀ ਹਾਂਜੀ ਠੀਕ ਹੈ ਹਾਂਜੀ ਇਹੀ ਮੇਰਾ ਵਟਸਐਪ ਨੰਬਰ ਹੈ ਹਾਂਜੀ ਓਕੇ ਓਕੇ ਥੈਂਕ ਯੂ ਮੈਮ